ਸਤਿ ਸ਼੍ਰੀ ਅਕਾਲ ਅਸੀਂ ਰੋਪੜ ਤੋਂ ਬੋਲ ਰਹੇ ਹਾਂ ਜੀ ਅਸੀਂ ਸਾਡੀ ਮਾਤਾ ਅੰਮ੍ਰਿਤਸਰ ਤੋਂ ਮਾਤਾ ਜੀ ਨੇ ਰੋਪੜ ਨੂੰ ਆਉਣਾ ਹੈ ਅਤੇ ਉਹਨਾਂ ਨੂੰ ਬੱਸ ਵਿੱਚ ਸਫਰ ਕਰਨ ਦੇ ਵਿੱਚ ਦਿੱਕਤ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵੱਲੋਂ ਕੋਈ ਗੱਡੀ ਪ੍ਰੋਵਾਈਡ ਕੀਤੀ ਜਾਵੇ ਜੋ ਕਿ ਸਾਡੀ ਮਾਤਾ ਜੀ ਕਰਕੇ ਤੁਸੀਂ ਬੁੱਕ ਕਰ ਦਿਉ ਔਰ ਉਹ ਰੋ ਅੰਮ੍ਰਿਤਸਰ ਤੋਂ ਸਾਡੀ ਮਾਤਾ ਜੀ ਨੂੰ ਰੋਪੜ ਪਹੁੰਚਾ ਦਿਉ ਔਰ ਜੋ ਉਸ ਦਾ ਖਰਚਾ ਹੈ ਕੁਛ ਵੀ ਹੈ ਤਾਂ ਉਹਨਾਂ ਦੀ ਸਾਨੂੰ ਮੇਸੈਜ ਕਰ ਦਿਉ ਔਰ ਅਸੀਂ ਰੋਪੜ ਤੱਕ ਇਹ ਬੁੱਕ ਕਰਾਉਣਾ ਚਾਹੁੰਦੇ ਹਾਂ ਸੋ ਧੰਨਵਾਦ ਜੀ